ਮਾਰਕੀਟ ਇੱਕ ਉਹ ਥਾਂ ਹੁੰਦੀ ਹੈ ਜਿੱਥੇ ਸਮਾਨ ਦਾ ਦੇਣ ਦੇਣ ਕੀਤਾ ਜਾਂਦਾ ਹੈ ਅਤੇ ਸਾਰੇ ਹੀ ਲੋਕ ਮਾਰਕੀਟ 'ਤੇ ਕਾਫ਼ੀ ਹੀ ਨਿਰਭਰ ਰਹਿੰਦੇ ਹਨ ਮਾਰਕੀਟ ਵਿੱਚ ਕਾਫ਼ੀ ਸਮਾਨ ਮਿਲਦੇ ਹਨ ਅਤੇ ਵੇਚੇ ਅਤੇ ਖਰੀਦੀ ਜਾਂਦੀ ਹਨ ਅਤੇ ਹਰੇਕ ਹਰੇਕ ਸਟੇਟ ਦਾ ਸਰਕਾਰਾਂ ਦਾ ਅਲੱਗ ਅਲੱਗ ਨਿਯਮ ਹੁੰਦਾ ਹੈ ਮਾਰਕੀਟਾਂ ਨੂੰ ਲੈ ਕੇ ਕਿੱਥੇ ਕਿੱਥੇ ਮਾਰਕੀਟ ਚੌਵੀ ਘੰਟੇ ਖੁੱਲ੍ਹੀ ਹੁੰਦੀ ਹੈ ਕਿੱਥੇ ਕਿੱਥੇ ਮਾਰਕੀਟ ਬਾਰ੍ਹਾਂ ਘੰਟੇ ਖੁੱਲ੍ਹੀ ਹੁੰਦੀ ਹੈ ਜਿਵੇਂ ਜਿਵੇਂ ਬੜੀ ਬੜੀ ਦੀਆਂ ਬੜੇ ਬੜੇ ਸ਼ਹਿਰ ਮੁੰਬਈ ਮਹਾਰਾਸ਼ਟਰ ਦਿੱਲੀ ਇਹ ਇਲਾਕਿਆਂ ਵਿੱਚ ਮਾਰਕੀਟ ਚੌਵੀ ਚੌਵੀ ਘੰਟੇ ਖੁੱਲ੍ਹੀ ਹੁੰਦੀ ਹਨ ਕਿਉਂਕਿ ਇੱਥੇ ਲੋਕ ਮਾਰਕੀਟ ਚੌਵੀ ਘੰਟੇ ਘੁੰਮਦੇ ਹਨ ਅਤੇ ਜਿਵੇਂ ਸਾਡਾ ਸ਼ਾਹਿਰ ਕਪੂਰਥਲੇ ਪੰਜਾਬ ਦੇ ਔਰ ਡਿਸਟਰਿਕ ਜਲੰਧਰ ਰੋਪੜ ਸੰਗਰੂਰ ਇੱਥੇ ਇੰਨੀ ਰਿਕਵਾਇਰਮੈਂਟ ਨਹੀਂ ਹੁੰਦੀ ਹੈ ਮੈਂ ਕਸਟਮਰਾਂ ਦੀ ਤਾਂ ਹੀ ਇੱਥੇ ਮਾਰਕੀਟ ਬਾਰ੍ਹਾਂ ਤੋਂ ਚੌਦਾਂ ਘੰਟੇ ਲਈ ਖੁੱਲ੍ਹੇ ਹੁੰਦੇ ਹਨ